ਖਾਣਾ ਬਣਾਉਣਾ ਸਿਰਫ ਔਰਤਾਂ ਦਾ ਕੰਮ ਨਹੀਂ ਅੱਜ ਦਾ ਯੁੱਗ ਬਦਲ ਗਿਆ ਹੈ ਅੱਜ ਮਰਦ ਵੀ ਔਰਤਾਂ ਦੇ ਨਾਲ ਕੰਧੇ ਨਾਲ ਕੰਧੇ ਮਿਲਾ ਕੇ ਕੰਮ ਕਰਦੇ ਹਨ ਅਤੇ ਅੱਜ ਮੇਰੇ ਪਰਿਵਾਰ ਦੇ ਵੀ ਮਰਦ ਖਾਣਾ ਬਣਾਉਂਦੇ ਹਨ ਅਤੇ ਮੇ ਮੇਰੇ ਘਰ ਦੇ ਕੰਮ ਦੇ ਵਿੱਚ ਖਾਣਾ ਬਣਾਉਣ 'ਚ ਮੇਰੀ ਮਦਦ ਕਰਦੇ ਹਨ ਖਾਣਾ ਬਣਾਉਣਾ ਲਈ ਇੱਕ ਅੱਜ ਕੱਲ੍ਹ ਮਰਦ ਆ ਸਾਡੇ ਘਰ ਦੇ ਮਰਦ ਤੋਂ ਇਲਾਵਾ ਵੀ ਹੋਰ ਅੱਜ ਹੋਰ ਹਰ ਹਰ ਖੇਤਰ ਦੇ ਵਿੱਚ ਖਾਸਕਰ ਕੁਕਿੰਗ ਦੇ ਖੇਤਰ ਦੇ ਵਿੱਚ ਇੰਡੀਆ ਦੇ ਵਿੱਚ ਵੀ ਬਹੁਤ ਸਾਰੇ ਮਰਦ ਨੇ ਆਪਣਾ ਪ੍ਰੋਫੈਸ਼ਨ ਬਣਾ ਲਿਆ ਹੈ ਸਭ ਇਸ ਇਸ ਨਾਲ ਕਿ ਇਹ ਮਰਦਾਂ ਨੂੰ ਕਿ ਜੇ ਕਿਸੇ ਵੇਲੇ ਘਰ ਦੀਆਂ ਔਰਤਾਂ ਬਿਮਾਰ ਹੋਣ ਤਾਂ ਕਿਸੇ ਹੋਰ ਦਾ ਮੂੰਹ ਨਹੀਂ ਦੇਖਣਾ ਪੈਂਦਾ ਉਹ ਆਪਣੇ ਉੱਤੇ ਸੈਲਫ ਡਿਪੈਂਡੈਂਟ ਹੋ ਜਾਂਦੇ ਹਨ ਅਤੇ ਉਹਨਾ ਨੂੰ ਉਹ ਆਪਣੇ ਆਪਣੇ ਸਵਾਦ ਅਨੁਸਾਰ ਆਪਣੇ ਪਸੰਦ ਸਵਾਦ ਅਨੁਸਾਰ ਆਪਣੇ ਪਸੰਦ ਦੇ ਅਨੁਸਾਰ ਉਹ ਆਪਣੇ ਖਾਣਾ ਬਣਾਉਣ ਦੀ ਤਿਆਰੀ ਕਰ ਸਕਦੇ ਹਨ